ਬੋਲੀਵੁੱਡ ਅਤੇ ਟੋਲੀਵੁੱਡ ਦੀਆਂ ਫਿਲਮਾਂ ਵਧੀਆ ਨੇ ਹੈ ਨਾ ਬਹੁਤ ਸਾਰੀਆਂ ਵਧੀਆਂ ਨੇ ਅਤੇ ਉਹਨਾਂ 'ਚੋਂ ਕਈ ਐਕਟਰ ਵਧੀਆ ਲੱਗਦੇ ਨੇ ਅਤੇ ਉਹਨਾਂ ਦਾ ਪਹਿਰਾਵਾ ਜੋ ਸਿੰਪਲ ਲੁੱਕ ਹੁੰਦੀ ਹੈ ਉਹ ਵਧੀਆ ਲੱਗਦੀ ਹੈ ਜ਼ਿਆਦਾ ਰੰਗ ਬਿਰੰਗੇ ਜਿਹੇ ਕੱਪੜੇ ਵੀ ਨਹੀਂ ਵਧੀਆ ਲੱਗਦੇ ਸਿੰਪਲ ਲੁਕ ਜੋ ਵਧੀਆ ਹੁੰਦੀ ਹੈ ਉਹ ਸਭ ਤੋਂ ਵਧੀਆ ਅਤੇ ਉਨ੍ਹਾਂ ਦੇ ਸਿੰਪਲ ਲੁੱਕ ਲਈ ਅਸੀਂ ਕੱਪੜੇ ਕਈ ਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਮਤਲਬ ਕਿ ਉਹੋ ਜਿਹੇ ਪਹਿਰਾਵਾ ਅਤੇ ਜ਼ਿਆਦਾਤਰ ਜੋ ਸਿੰਪਲ ਲੁੱਕ ਫਿਲਮਾਂ 'ਚ ਹੁੰਦੀ ਹੈ ਉਸ ਨੂੰ ਅਸੀਂ ਕਈ ਵਾਰ ਮੈਂ ਜ਼ਿਆਦਾਤਰ ਉਹੀ ਕੱਪੜਿਆਂ ਨੂੰ ਪਹਿਨਦਾ ਅਤੇ ਉਸ ਵਿੱਚ ਸਾਨੂੰ ਇਹ ਵਧੀਆ ਲੱਗਦਾ ਕਿ ਜੋ ਫਿਲਮਾਂ 'ਚ ਸੱਭਿਆਚਾਰ ਦਿਖਾਇਆ ਜਾਂਦਾ ਹੈ ਨਾ ਉਹ ਚੰਗੀ ਗੱਲ ਹੁੰਦੀ ਹੈ ਕਿ ਹਾਂ ਆਪਣੇ ਇਤਿਹਾਸ ਨੂੰ ਸੱਭਿਆਚਾਰ ਨੂੰ ਪਿਛੋਕੜ ਨੂੰ ਅੱਗੇ ਲੈ ਕੇ ਚੱਲਣਾ ਅਤੇ ਉਸਨੂੰ ਦਿਖਾਉਣਾ ਅਤੇ ਉਸ ਦੀ ਗੱਲ ਕਰਨੀ ਅਤੇ ਆਪਣੇ ਆਪਣੇ ਸਮਾਜ ਲਈ ਹੱਕ ਸੱਚ ਲਈ ਖੜ੍ਹਨਾ ਅਤੇ ਹੱਕ ਸੱਚ ਦੀਆਂ ਫਿਲਮਾਂ ਹੀ ਵਧੀਆ ਲੱਗਦੀਆਂ ਨੇ ਅਤੇ ਇਸੇ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਵੀ ਚਾਹੀਦੀਆਂ ਹਨ